ਭਾਰਤ ਵਿੱਚ ਟੀ ਵੀ ਤੋਂ ਦੇਖ ਕੇ ਬੱਚੇ ਨੌਜਵਾਨ ਬਹੁਤ ਪ੍ਰਭਾਵ ਹੁੰਦੇ ਹਨ ਜਿਵੇਂ ਜਿਵੇਂ ਟੀ ਵੀ ਵਿੱਚ ਸੀਰੀਅਲ ਵਗੈਰਾ ਆਉਂਦੇ ਹਨ ਉਕਣਾ ਹੀ ਦੇਖ ਕੇ ਬੱਚੇ ਵੀ ਕਰਦੇ ਹਨ ਬੱਚੇ ਰੀਲਾਂ ਬਣਾਉਂਦੇ ਹਨ ਇੱਕ ਦੂਜੇ ਨੂੰ ਭੇਜਦੇ ਹਨ ਬਣਾ ਕੇ ਰੀਲਾਂ ਅਤੇ ਆਪਣਾ ਬੱਚੇ ਟੀ ਵੀ ਤੋਂ ਬਹੁਤ ਕੁਝ ਸਿੱਖਦੇ ਵੀ ਹਨ ਮੋਬਾਇਲ ਤੋਂ ਸਿੱਖਦੇ ਵੀ ਹਨ ਇੰਟਰਨੈੱਟ 'ਤੇ ਪਾਉਂਦੇ ਹਨ ਸਿੱਖ ਕੇ ਅਤੇ ਪੰਜਾਬ ਵਿੱਚ ਭਾਰਤ ਵਿੱਚ ਪੰਜਾਬੀ ਗਾਣੇ ਤਕਰੀਬਨ ਵੱਧ ਤੋਂ ਵੱਧ ਸੁਣੇ ਜਾਂਦੇ ਹਨ